ਪੰਜਾਬ ਵਿੱਚ ਪੰਜਾਬੀ ਲੋਕ ਆਪਣੇ ਅ ਮੇਨ ਅ ਕਾਰ ਵਿਹਾਰ ਕਰਨ ਲਈ ਪੰ ਆਪਣੀ ਭਾਸ਼ਾ ਵਿੱਚ ਲੋਕ ਗੀਤ ਗਾਉਂਦੇ ਹਨ ਜਿਵੇਂ ਲੜਕੀ ਦੇ ਵਿਆਹ ਸਮੇਂ ਸੁਹਾਗ ਗਾਇਆ ਜਾਂਦਾ ਹੈ ਅਤੇ ਲੜਕੇ ਦੇ ਵਿਆਹ ਸਮੇਂ ਘੋੜੀਆਂ ਆਦਿ ਗਾਈਆਂ ਜਾਂਦੀਆਂ ਹਨ ਅਤੇ ਇਹ ਇਸ ਸਬੰਧੀ ਇੱਕ ਦਿਨ ਪਹਿਲਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਜਦੋਂ ਵੱਟਨਾ ਲਗਾਇਆ ਜਾਂਦਾ ਹੈ ਤਾਂ ਉਦੋਂ ਇਸਤਰੀਆਂ ਇਕੱਠੀਆਂ ਹੋ ਕੇ ਲੋਕ ਗੀਤ ਗਾਉਂਦੀਆਂ ਹਨ ਅਤੇ ਹਰੇਕ ਮੌਕੇ ਵਾਸਤੇ ਅਲੱਗ ਅਲੱਗ ਲੋਕ ਗੀਤ ਹਨ ਇਸੇ ਤਰ੍ਹਾਂ ਹੀ ਵਿਆਹ ਸਮੇਂ ਜੋ ਰਿਸ਼ਤੇਦਾਰੀਆਂ ਦੇ ਅਨੁਸਾਰ ਅਲੱਗ ਅਲੱਗ ਲੋਕ ਗੀਤ ਹਨ ਹਰੇਕ ਰਿਸ਼ਤੇਦਾਰੀ ਲਈ ਚਾਹੇ ਨਾਨਕੇ ਹੋਣ ਚਾਹੇ ਦਾਦਕੇ ਹੋਣ ਉਹਨਾਂ ਲਈ ਅਲੱਗ ਅਲੱਗ ਲੋਕ ਗੀਤ ਹੈ ਅਤੇ ਇਹ ਇਹਨਾਂ ਲੋਕ ਗੀਤਾਂ ਵਿੱਚ ਹਾਸਾ ਵਿਅੰਗ ਆਦਿ ਦੋਨਾਂ ਚੀਜ਼ਾਂ ਦਾ ਸੁਮੇਲ ਹੁੰਦਾ ਹੈ ਅਤੇ ਇਹ ਇੱਕ ਤਰ੍ਹਾਂ ਨਾਲ ਮਨੋਰੰਜਨ ਦਾ ਸਾਧਨ ਵੀ ਬਣਦੇ ਹਨ ਅਤੇ ਇੱਕੋ ਗੱਲ ਹੋਰ ਹੀ ਸਿੱਖਿਆ ਵੀ ਇਹਨਾਂ ਵਿੱਚ ਦਿੱਤੀ ਜਾਂਦੀ ਹੈ ਲੜਕੀ ਨੂੰ ਅੱਗੇ ਆਪਣੇ ਸਹੁਰੇ ਪਰਿਵਾਰ ਵਿੱਚ ਰਹਿਣ ਸੰਬੰਧੀ ਨਸੀਅਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਨਾਲ ਪਰਿਵਾਰਕ ਮੇਲ ਮਿਲਾਪ ਵੱਧਦਾ ਹੈ ਅਤੇ ਰਿਸ਼ਤੇਦਾਰੀਆਂ ਵਿੱਚ ਮਿਠਾਸ ਵੀ ਵੱਧਦੀ ਹੈ ਅਤੇ ਇਸ ਨਾਲ ਇੱਕ ਚੰਗਾ ਮਹੌਲ ਬਣ ਜਾਂਦਾ ਹੈ ਅਤੇ ਮਨੋਰੰਜਨ ਵੀ ਹੋ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਇਹੀ ਹੀ ਇੱਕ ਮਨੋਰੰਜਨ ਦਾ ਪ੍ਰਮੁੱਖ ਸਾਧਨ ਸੀ ਅਜੋਕੇ ਸਮੇਂ ਵਿੱਚ ਤਾਂ ਬਹੁਤ ਜ਼ਿਆਦਾ ਹੋਰ ਮਨੋਰੰਜਨ ਦੇ ਸਾਧਨ ਉਪਲਬਧ ਹਨ ਪਰ ਪੁਰਾਣੇ ਸਮਿਆਂ ਵਿੱਚ ਇਸ ਨਾਲ ਹੀ ਮਨੋਰੰਜਨ ਦਾ ਮ ਅਅ ਆਨੰਦ ਹੁੰਦਾ ਸੀ ਅਤੇ ਰਾਤ ਨੂੰ ਇਕੱਠੇ ਹੋ ਕੇ ਇਕੱਠੇ ਬਹਿ ਕੇ ਖਾਣਾ ਖਾਣਾ ਇਸ ਸਭ ਕਾਰ ਵਿਹਾਰ ਦਾ ਹਿੱਸਾ ਹੁੰਦੇ ਸਨ